ਹਾਂ ਮੈਂ ਪਹਿਲੀ ਵਾਰ ਭੰਗੜਾ ਪਾਉਂਦੇ ਗੱਭਰੂਆਂ ਦੀ ਅ ਡਰਾਇੰਗ ਬਣਾਈ ਸੀ ਜੋ ਕਿ ਮੈਂ ਐਵੇਂ ਹੀ ਮੈਮ ਕੋਲ ਜਾ ਕੇ ਦਿਖਾਈ ਉਹਨਾਂ ਨੇ ਮੈਨੂੰ ਪੁੱਛਿਆ ਵੀ ਤੁਸੀਂ ਨੇ ਇਹ ਕੀ ਸੋਚ ਕੇ ਬਣਾਈ ਹੈ ਤਾਂ ਫਿਰ ਮੈਂ ਕਿਹਾ ਜੀ ਮੈਨੂੰ ਬਹੁਤ ਵਧੀਆ ਲੱਗੀ ਇਹ ਤਸਵੀਰ ਇਸ ਲਈ ਮੈਨੇ ਇਹ ਬਣਾ ਦਿੱਤੀ ਫਿਰ ਮੇਰੀ ਮੈਮ ਮੈਡਮ ਨੇ ਇਹਦੇ ਬਾਰੇ ਦੱਸਿਆ ਵੀ ਭੰਗੜੇ ਦਾ ਕੀ ਮਹੱਤਵ ਹੈ ਭੰਗੜੇ ਪੰਜਾਬ ਦਾ ਭ ਮੁੱਖ ਨਾਚ ਹੈ ਜੋ ਕਿ ਗੱਭਰੂਆਂ ਦੁਆਰਾ ਪਾਇਆ ਜਾਂਦਾ ਹੈ ਦੂਜਾ ਸਾਡਾ ਮੁੱਖ ਨਾਚ ਪੰਜਾਬ ਦਾ ਗਿੱਧਾ ਹੈ ਜੋ ਕਿ ਮੁਟਿਆਰਾਂ ਦੁਆਰਾ ਪਾਇਆ ਜਾਂਦਾ ਹੈ ਇਹ ਭੰਗੜਾ ਤਕਰੀਬਨ ਖੁਸ਼ੀ ਦੇ ਮੌਕੇ 'ਤੇ ਪਾਇਆ ਜਾਂਦਾ ਹੈ ਜਦੋਂ ਪੰਜਾਬ ਵਿੱਚ ਜਾਂ ਕਿਸੇ ਵੀ ਦੇਸ਼ ਵਿੱਚ ਅ ਫ਼ਸਲ ਪੱਕਦੀ ਹੈ ਤਾਂ ਉਦੋਂ ਉਸ ਦੀ ਖੁਸ਼ੀ ਵਿੱਚ ਫ਼ਸਲ ਪੱਕਣ ਦੀ ਖੁਸ਼ੀ ਵਿੱਚ ਭੰਗੜਾ ਨਾਚ ਕੀਤਾ ਜਾਂਦਾ ਹੈ ਇਹ ਗੱਭਰੂ ਪਾਉਂਦੇ ਹਨ ਇਹ ਵਿਸਾਖੀ ਦੇ ਮੇਲੇ 'ਤੇ ਪਾਇਆ ਜਾਂਦਾ ਹੈ ਵਿਆਹ ਮੰਗਣੇ ਅਤੇ ਤਿਉਹਾਰਾਂ ਆਦਿ ਸ਼ਾਮਿਲ ਇਹਨਾਂ ਵਿੱਚ ਪਾਇਆ ਜਾਂਦਾ ਹੈ ਇਹ ਲੋਕ ਨਾਚ ਪੰਜਾਬ ਦੀ ਕਿਸਾਨ ਸੰਸਕ੍ਰਿਤ ਜਿੰਨਾ ਹੀ ਪ੍ਰਾਚੀਨ ਹੈ ਲੋਕਧਾਰਾ ਵਿਗਿਆਨੀ ਸੋਹਿੰਦਰ ਸਿੰਘ ਵਣਜਾਰਾ ਬੇਦੀ ਦੇ ਸ਼ਬਦਾਂ ਵਿੱਚ ਪਹਿਲਾ ਪਹਿਲਾ ਜਦੋਂ ਪੰਜਾਬੀਆਂ ਹਰੀ ਫਸਲਾਂ ਤੋਂ ਸੁਨਹਿਰੀ ਹੁੰਦੀਆਂ ਸਨ ਉਦੋਂ ਇਹ ਭੰਗੜਾ ਪਾਇਆ ਜਾਂਦਾ ਸੀ